ਮੈਂ ਆਪਣੇ ਜੀਵਨ ਵਿੱਚ ਬਹੁਤ ਕਿਤਾਬਾਂ ਪੜ੍ਹੀਆਂ ਅਤੇ ਉਹਨਾਂ ਨੂੰ ਆਪਣੇ ਜੀਵਨ ਦੇ ਅਨੁਸਾਰ ਸਮਝਿਆ ਪਰ ਸਭ ਤੋਂ ਪ੍ਰਭਾਵਿਤ ਕਰਨ ਵਾਲੀ ਮੈਨੂੰ ਇਹੋ ਹਮਾਰਾ ਜੀਵਣਾ ਨਾਵਲ ਜੋ ਕਿ ਦਲੀਪ ਕੌਰ ਟਿਵਾਣਾ ਵੱਲੋਂ ਲਿਖਿਆ ਗਿਆ ਨੇ ਪ੍ਰਭਾਵਿਤ ਕੀਤਾ ਇਸ ਨਾਵਲ ਵਿੱਚ ਔਰਤ ਦੀ ਸਥਿਤੀ ਜੋ ਕਿ ਇੱਕ ਦਬੀ ਅਤੇ ਇੱਕ ਵਸਤੂ ਵਾਂਗ ਉਪਯੋਗ ਹੋਣ ਵਾਲੀ ਸਥਿਤੀ ਵਿੱਚ ਹੈ ਨੂੰ ਪੇਸ਼ ਕੀਤਾ ਇਸ ਨਾਵਲ ਰਾਹੀਂ ਦਲੀਪ ਕੌਰ ਟਿਵਾਣਾ ਔਰਤਾਂ ਦੀ ਮੁੱਖ ਸਮੱਸਿਆ ਨੂੰ ਪੇਸ਼ ਕਰਦੀ ਹੈ ਜਿਸ ਵਿੱਚ ਔਰਤ ਦਾ ਵਸਤੂ ਵਾਂਗ ਵੇਚ ਕੇ ਵੇਚਣਾ ਅਤੇ ਖਰੀਦਣਾ ਦਿਖਾਇਆ ਗਿਆ ਹੈ ਇਹੋ ਹਮਾਰਾ ਜੀਵਣਾ ਵਿੱਚ ਜੋ ਵੀ ਦ੍ਰਿਸ਼ ਪੇਸ਼ ਹੋਏ ਉਸਦੇ ਕੁਝ ਦ੍ਰਿਸ਼ ਮੈਂ ਆਪਣੇ ਆਲੇ ਦੁਆਲੇ ਵੀ ਵੇਖੇ ਇਹਨਾਂ ਦ੍ਰਿਸ਼ ਦ੍ਰਿਸ਼ਾਂ ਨੇ ਮੈਨੂੰ ਝੰਜੋੜਿਆ ਅਤੇ ਮੇਰੀ ਮਾਨਸਿਕ ਅਤੇ ਬੌਧਿਕ ਸਥਿਤੀ ਉੱਤੇ ਪ੍ਰਭਾਵ ਪਾਇਆ ਮੈਂ ਅਕਸਰ ਹੀ ਆਪਣੇ ਇਸ ਨਾਵਲ ਦੀ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਕਰਦਾ ਰਹਿੰਦਾ ਹਾਂ ਅਤੇ ਇਸ ਸਮੱਸਿਆ ਨੂੰ ਗੰਭੀਰ ਲੈਣ ਅਤੇ ਇਸ ਨੂੰ ਵਿਚਾਰਨ ਲਈ ਕਹਿੰਦਾ ਹਾਂ ਔਰਤਾਂ ਦੀ ਸਥਿਤੀ ਨੂੰ ਸੁਧਾਰਨ ਅਤੇ ਉਸ ਵਿੱਚ ਕੁਝ ਹੋਰ ਸੁਧਾਰ ਕਰਨ ਲਈ ਆਪਣੇ ਆਸ ਪਾਸ ਦੇ ਲੋਕਾਂ ਨੂੰ ਪ੍ਰੇਰਤ ਵੀ ਕਰਦਾ ਰਹਿੰਦਾ ਹਾਂ ਧੰਨਵਾਦ